ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਜਿਵੇਂ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ਅਤੇ ਵੱਖ ਵੱਖ ਕਿਤਾਬਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਚਾਰ ਵੀ ਮਿਲਦੇ ਨੇ ਪਰ ਇੱਕ ਕਿਤਾਬ ਜਿਹੜੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਇਸ ਤੋਂ ਬਿਨਾਂ ਮੈਂ ਵੱਖ ਵੱਖ ਤਰ੍ਹਾਂ ਦੇ ਰੀਡਿੰਗ ਕਲੱਬਾਂ ਦੇ ਵਿੱਚ ਵੀ ਸ਼ਾਮਿਲ ਹੋਈ ਹਾਂ ਜਿਹਦੇ ਵਿੱਚ ਸੈਂਟਰਲ ਲਾਈਬ੍ਰੇਰੀ ਹੋ ਗਈ ਖਾਲਸਾ ਕਾਲਜ ਪਟਿਆਲਾ ਦੀ ਲਾਈਬ੍ਰੇਰੀ ਹੋ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਈਬ੍ਰੇਰੀ ਹੋ ਗਈ ਆਰਕਾਈਵਸ ਪਟਿਆਲਾ ਇਸ ਤੋਂ ਬਿਨਾਂ ਲੇਖਕਾਂ ਦੇ ਵੀ ਬਹੁਤ ਸਾਰੇ ਜਿਹੜੇ ਕਲੱਬ ਬਣੇ ਹੋਏ ਨੇ ਰੀਡਿੰਗ ਕਲੱਬ ਜਿਨ੍ਹਾਂ ਦੇ ਵਿੱਚ ਵੱਖ ਵੱਖ ਪੁਸਤਕਾਂ ਨੇ ਜਿਹੜੀਆਂ ਪੜ੍ਹਨ ਤੋਂ ਬਾਅਦ ਉਹਨਾਂ ਦੇ ਬ ਬਾਰੇ ਵਿਚਾਰ ਵਿਟਾਂਦਰਾ ਕੀਤਾ ਜਾਂਦਾ ਹੈ ਅਤੇ ਮੈਂਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਇੱਕ ਕਿਤਾਬ ਹੈ ਡੋਕਟਰ ਜੋਸਫ ਮਰਫੀ ਉਸ ਕਿਤਾਬ ਦੇ ਲੇਖਕ ਨੇ ਕਿਤਾਬ ਦਾ ਨਾਮ ਹੈਗਾ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਆਪਣੀ ਜ਼ਿੰਦਗੀ ਵਿੱਚ ਬਦਲਾਵ ਮਹਿਸੂਸ ਹੋਇਆ ਇਸ ਕਿਤਾਬ ਨੂੰ ਪੜ੍ਹ ਕੇ ਮੈਂ ਬਦਲਾਵ ਲਿਆਂਦਾ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਮੈਨੂੰ ਬਹੁਤ ਸਾਰਾ ਚੰਗੇ ਨਤੀਜੇ ਪ੍ਰਾਪਤ ਹੋਏ ਇਸ ਦੇ ਇਸ ਕਿਤਾਬ ਦੇ ਰਾਹੀਂ ਮੈਂ ਮਾਨਸਿਕ ਰੂਪ ਦੇ ਵਿੱਚ ਹੋਰ ਮਜ਼ਬੂਤ ਹੋਈ ਹਾਂ ਮਾਨਸਿਕ ਰੂਪ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਮੈਨੂੰ ਮ ਮੇਰੇ ਇੱਕ ਸੁਭਾਅ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪਾਇਆ ਉਸ ਚੰਗੇ ਪ੍ਰਭਾਵ ਦੇ ਰਾਹੀਂ ਮੈਂ ਬਹੁਤ ਸਾਰਾ ਮੇਰਾ ਸੁਭਾਅ ਦੇ ਵਿੱਚ ਮਤਲਬ ਬਦਲਾਵ ਮਹਿਸੂਸ ਕੀਤਾ ਜਿਹਦੇ ਨਾਲ ਮੈਨੂੰ ਜਿਹੜੀਆਂ ਪੋਜ਼ੀਟਿਵ ਹ ਚੀਜ਼ਾਂ ਨੇ ਜਿਹੜੀਆਂ ਉਹ ਉਹਨਾਂ ਵੱਲ ਮੈਂ ਵਧੀ ਹਾਂ ਅਤੇ ਨੈਗਟੀਵਿਟੀ ਜਿਹੜੀ ਹੈਗੀ ਆ ਉਹ ਮੇਰੇ ਮਾਇੰਡ ਦੇ ਵਿੱਚੋਂ ਮੇਰੇ ਮਨ ਦੇ ਵਿੱਚੋਂ ਖ਼ਤਮ ਹੋਈ ਹੈ ਨੈਗਟੀਵਿਟੀ ਦੀ ਥਾਂ ਦੇ ਉੱਤੇ ਮੈਂ ਪੋਜ਼ੀਟਿਵ ਮਹਿਸੂਸ ਕਰਨ ਲੱਗੀ ਹਾਂ ਅਤੇ ਹਮੇਸ਼ਾਂ ਉਤਸ਼ਾਹ ਜਿਹੜਾ ਮਨ ਦੇ ਵਿੱਚ ਰਹਿਣ ਲੱਗ ਪਿਆ ਹੈ